ਪੰਜਾਬੀ ਭਾਸ਼ਾ ਜੋ ਕਿ ਸਾਡੀ ਮਾਂ ਬੋਲੀ ਭਾਸ਼ਾ ਹੈ ਬਹੁਤ ਹੀ ਮਿੱਠੀ ਭਾਸ਼ਾ ਹੈ ਇਸ ਦੀ ਜੋ ਬਣਤਰ ਹੈ ਬੋਲਣ ਵ ਬੋਲਣ ਦੇ ਵਿੱਚ ਇਹ ਹਿੰਦੀ ਭਾਸ਼ਾ ਦੀ ਤਰ੍ਹਾਂ ਹੀ ਲਗਭਗ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਜੋ ਕਿ ਪੰਜਾਬ ਦੇ ਵਿੱਚ ਪੰਜਾਬ ਰਾਜ ਸਟੇਟ ਦੇ ਵਿੱਚ ਬੋਲੀ ਜਾਂਦੀ ਹੈ ਪਰ ਨਾਲ ਦੀ ਨਾਲ ਹੁਣ ਇਹ ਭਾਸ਼ਾ ਪੂਰੇ ਵਰਲਡ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਜਿਵੇਂ ਕਿ ਕਨੇਡਾ ਅਮੈਰੀਕਾ ਇੰਗਲੈਂਡ ਯੂਰਪ ਦੁਬਈ ਇਹਨਾਂ ਕੰਟਰੀਆਂ ਦੇ ਵੇ ਵਿੱਚ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਜੋ ਕਿ ਨਵੇਂ ਸਕੂਲ ਬ ਅੱਜ ਕੱਲ੍ਹ ਬਣ ਖੁੱਲ੍ਹ ਰਹੇ ਹਨ ਜਿਵੇਂ ਕਿ ਕੋਂਨਵਟ ਸਕੂਲ ਸੀ ਬੀ ਐੱਸ ਈ ਪੈਟਰਨ ਸਕੂਲ ਇਹਨਾਂ ਦੇ ਵਿੱਚ ਬੜੀ ਦੁਖਾਂਤ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਇਹਨਾਂ ਨੂੰ ਜੋ ਕਿ ਇਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਤੋਂ ਬੱਚਿਆਂ ਨੂੰ ਰੋਕਿਆ ਜਾਂਦਾ ਹੈ ਉਹਨਾਂ ਨੂੰ ਸਿਰਫ ਇੰਗਲਿਸ਼ ਉੱਤੇ ਜ਼ੋਰ ਲਾਇਆ ਜਾਂਦਾ ਹੈ ਵੀ ਇਕੱਲੀ ਇੰਗਲਿਸ਼ ਹੀ ਬੋਲਣੀ ਹੈ ਜੋ ਕਿ ਇੱਕ ਬਹੁਤ ਜ਼ਿਆਦਾ ਗਲਤ ਗੱਲ ਹੈ ਅਤੇ ਪੰਜਾਬ ਵਿੱਚ ਵੀ ਜੋ ਪੰਜਾਬੀ ਭਾਸ਼ਾ ਹੈ ਉਸ ਦੇ ਕਈ ਕਈ ਕਈ ਤਰ੍ਹਾਂ ਦੇ ਅਲੱਗ ਅਲੱਗ ਰੂਪ ਜੋ ਕਿ ਹਨ ਜਿਵੇਂ ਕਿ ਮਾਲਵੇ ਦੇ ਵਿੱਚ ਪੰਜਾਬੀ ਭਾਸ਼ਾ ਕੁਛ ਹੋਰ ਤਰੀਕੇ ਨਾਲ ਬੋਲੀ ਜਾਂਦੀ ਹੈ ਦੁਆਬੇ ਦੇ ਵਿੱਚ ਹੋਰ ਤਰੀਕੇ ਨਾਲ ਬੋਲੀ ਜਾਂਦੀ ਹੈ ਮਾਝੇ ਦੇ ਵਿੱਚ ਹੋਰ ਤਰੀਕੇ ਨਾਲ ਬੋਲੀ ਜਾਂਦੀ ਹੈ ਇਸੇ ਤਰ੍ਹਾਂ ਨਾਲ ਲੱਗਦੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵੀ ਪੰਜਾਬੀ ਭਾਸ਼ਾ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਬੋਲੀ ਜਾਂਦੀ ਹੈ ਪ੍ਰਫੁੱਲਤ ਅ ਹੋ ਰਹੀ ਹੈ ਪਾਕਿਸਤਾਨ ਦੇ ਪੰਜਾਬ ਰਾਜ ਦੇ ਵਿੱਚ ਵੀ